ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੋ ਜੂ ਅਡਮੀਸ਼ਨ ਹਾਂਜੀ ਕੋਰਸ ਬਹੁਤ ਸਾਰੇ ਇੱਥੇ ਇੰਜੀਨਰਿੰਗ ਰਿਲੇਟਡ ਸਾਰੇ ਕੋਰਸ ਹੈ ਨੇ ਜਿਵੇਂ ਕਿ ਬੀ ਟੈਕ ਕਰ ਸਕਦੇ ਹੋ ਬੀ ਟੈਕ ਵਿੱਚ ਵਿੱਚ ਕੰਪਿਊਟਰ ਸਾਇੰਸ ਕੋਰਸ ਬਹੁਤ ਵਧੀਆ ਆਈ ਟੀ ਕਰ ਸਕਦੇ ਹੋ ਇਨਫੋਰਮੇਸ਼ਨ ਟੈਕਨੋਲਜੀ ਹੋਰ ਵੀ ਬਹੁਤ ਸਾਰੇ ਕੋਰਸ ਨੇ ਜਿਵੇਂ ਬੀ ਸੀ ਏ ਵਗੈਰਾ

ਹਾਂਜੀ ਪਰਸੈਂਟਏਜ ਦੇ ਹਿਸਾਬ 'ਤੇ ਥੋੜ੍ਹੀ ਜਿਹੀ ਫੀਸ ਵੀ ਤੁਹਾਨੂੰ ਘੱਟ ਹੋ ਜੂਗੀ ਉਹ ਟੈਨਸ਼ਨ ਨਾ ਲਓ ਤੁਸੀਂ

ਹਾਂ ਹਾਂ ਹਾਂਜੀ ਹੋ ਜੂਗੀ ਸਕੋ ਸਕੋਲਰਸ਼ਿਪ ਹਾਂਜੀ ਹਾਂਜੀ ਅਡਮੀਸ਼ਨ ਹਜੇ ਖੁੱਲ੍ਹੀ ਦਿਸੰਬਰ ਮਹੀਨੇ ਤੱਕ ਅਤੇ ਰਜਿਸਟ੍ਰੇਸ਼ਨ ਤੁਹਾਨੂੰ ਪਹਿਲੇ ਕਰਨੀ ਪੈਣੀ ਔਨਲਾਈਨ ਵੈੱਬਸਾਈਟ 'ਤੇ ਜਾ ਕੇ ਕੋਲੇਜ ਦੀ ਨਹੀਂ ਰਜਿਸਟ੍ਰੇਸ਼ਨ ਤੁਹਾਨੂੰ ਪਹਿਲਾਂ ਵੈੱਬਸਾਈਟ ਤੋਂ ਕਰਨੀ ਪੈਣੀ ਹੈ ਉਸ ਤੋਂ ਬਾਅਦ ਤੁਹਾਨੂੰ ਇੱਕ ਨੋਟੀਫਿਕੇਸ਼ਨ ਆਏਗਾ ਜੀਮੇਲ 'ਤੇ ਫਿਰ ਤੁਸੀਂ ਕੋਲੇਜ ਜਾ ਕੇ ਅਡਮੀਸ਼ਨ ਕਰਾ ਸਕਦੇ ਹੋ

ਹਾਂਜੀ ਹਾਂਜੀ ਬੀ ਟੈੱਕ ਸੀ ਐੱਸ ਸੀ ਦੀ ਸੀਟਾਂ ਬਹੁਤ ਅਵੈਲਏਬਲ ਨੇ ਹਜੇ ਹਾਂਜੀ ਬਾਕੀ ਤੁਸੀਂ ਜਦੋਂ ਮਰਜੀ ਆ ਸਕਦੇ ਹੋ ਸਵੇਰੇ ਨੌਂ ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਕੋਲੇਜ ਖੁੱਲ੍ਹਾ ਰਹਿੰਦਾ ਜੇ ਇੱਕ ਬਾਰ ਤੁਸੀਂ ਆ ਕੇ ਇਸ ਦਾ ਕੈਂਪਸ ਦੇਖ ਸਕਦੇ ਹੋ ਹਾਂਜੀ ਹਾਂਜੀ ਤੁਸੀਂ ਕੋਲੇਜ ਵਿਜਿਟ ਕਰੋਗੇ ਤਾਂ ਤੁਸੀਂ ਜਗਦੇਵ ਸਰ ਕੋਲ ਸਰ ਦੇ ਆੱਫਿਸ 'ਚ ਜਾ ਸਕਦੇ ਹੋ ਉਹ ਤੁਹਾਨੂੰ ਬਾਕੀ ਦਾ ਸਾਰਾ ਪ੍ਰੋਸੈਸ ਦੱਸ ਦੇਣਗੇ ਅਡਮੀਸ਼ਨ ਦਾ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਆਉਂਦੀ ਹੈ ਤਾਂ ਹਾਂਜੀ ਹਾਂਜੀ ਨਹੀਂ ਇਨਕਮ ਦੀ ਕੋਈ ਟੈਨਸ਼ਨ ਨਹੀਂ ਤੁਹਾਨੂੰ ਬਾਕੀ ਸਕੋ ਸਕੋਲਰਸ਼ਿਪ ਵੀ ਲੱਗ ਜਾਊਗੀ ਅਤੇ ਪਰਸੈਂਟਏਜ ਦੇ ਬਾਰਵੀਂ ਦੀ ਪਰਸੈਂਟਏਜ ਦੇ ਹਿਸਾਬ ਨਾਲ ਥੋੜ੍ਹੀ ਜਿਹੀ ਮਤਲਬ ਤੁਹਾਨੂੰ ਰਿਆਇਤ ਵੀ ਹੋ ਜੂਗੀ ਫੀਸ ਵਿੱਚ ਹਾਂਜੀ ਹਾਂਜੀ ਧੰਨਵਾਦ